ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਉਹ ਭਾਅ ਜੀ ਮੈਂ ਰਮਨਦੀਪ ਬੋਲਦਾ ਪਿਆ ਹਾਂ ਮਿੰਟੂ ਦਾ ਬੇਟਾ ਮਿੰਟੂ ਦਾ ਭਾਪਾ ਬੋਲਦਾ ਹਾਂ ਹਾਂਜੀ ਹਾਂਜੀ ਉਹ ਮੈਂ ਕਿਹਾ ਉਹ ਮੈਂ ਨਾ ਬੇਟੇ ਆਪਣੇ ਦੇ ਬਾਰੇ ਸਕੂਲ ਚੇਂਜ ਕਰਵਾਉਣ ਬਾਰੇ ਗੱਲ ਕਰਨੀ ਸੀਗੀ ਉਹ ਜਿੱਥੇ ਪੜ੍ਹਦਾ ਸੀਗਾ ਤੇ ਉਹ ਨਾ ਸਕੂਲ ਕੋਈ ਵਧੀਆ ਨਹੀਂ ਲੱਗਿਆ ਮੈਨੂੰ ਪਰਫੋਰਮਸ ਉੱਥੇ ਇੱਦਾਂ ਬੱਚੇ ਦਾ ਹੁਣ ਭਵਿੱਖ ਦੀ ਗੱਲਬਾਤ ਹੈ ਥੋੜ੍ਹਾ ਜਿਹਾ ਵਧੀਆ ਮੈਂ ਕਿਹਾ ਸਕੂਲ ਹੋਵੇ ਅਤੇ ਤੁਸੀਂ ਹੁਣ ਇੱਥੇ ਰਹਿੰਦੇ ਹੋ ਲੋਕਲ ਤਾਂ ਮੈਂ ਕਿਹਾ ਤੁਸੀਂ ਵੀ ਦੱਸ ਦਿਓ ਵਧੀਆ ਸਕੂਲ ਕਿਹੜਾ ਇੱਥੇ ਲਾਗੇ ਸ਼ਾਗੇ ਕੋਈ ਜਿੱਥੇ ਮਤਲਬ ਕਿ ਕਲਾਸ ਹੁਣ ਗਿਆਰਵੀਂ ਕਰ ਲਈ ਹੈ ਅਤੇ ਹੁਣ ਬਾਰਵੀਂ 'ਚ ਪਾਉਣਾ ਵਾ ਤੇ ਹੁਣ ਮੈਂ ਕਿਹਾ ਤੁਸੀਂ ਦੱਸ ਦਿਓ ਤੁਸੀਂ ਹਿਸਾਬ ਸਿਰ ਜਿਹੜਾ ਵੀ ਵਧੀਆ ਹੋਵੇ ਸਕੂਲ ਜਿੱਥੇ ਫੀਸ ਵਗੈਰਾ ਵੀ ਥੋੜ੍ਹੀ ਹਿਸਾਬ ਸਿਰ ਹੋਵੇ ਅਤੇ ਮਤਲਬ ਕਿ ਸਾਰੀਆਂ ਐਕਟੀਵਿਟੀ ਵੀ ਵਗੈਰਾ ਵੀ ਸਾਰੀਆਂ ਹੋਣ ਦੇਖ ਲਿਓ ਤੁਸੀਂ ਆਪਣੇ ਹਿਸਾਬ ਨਾਲ ਕੋਈ ਦੱਸ ਦਿਓ ਲਾਗੇ ਸ਼ਾਗੇ ਕਿਹੜੇ ਕਿਹੜੇ ਸਕੂਲ ਆ ਇੱਥੇ ਕੋਈ ਵਧੀਆ ਦੱਸ ਦਿਓ ਮਾੜੇ ਜਿਹੇ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅਤੇ ਬਾਕੀ ਆਪਣਾ ਪੜ੍ਹਾਈ ਵਗੈਰਾ ਠੀਕ ਆ ਉੱਥੇ ਅੱਛਾ ਫ਼ੀਸਾਂ ਜ਼ਿਆਦਾ ਠੀਕ ਹੈ ਜੀ ਨਹੀਂ ਬਲਕਿ ਫੀਸ ਵੀ ਚਲੋ ਚਲ ਮਤਲਬ ਕੋਈ ਨਹੀਂ ਚਲੋ ਫੀਸ ਵੀ ਚਲੋ ਕਰ ਲਾਂਗੇ ਮਤਲਬ ਕਿ ਪੜ੍ਹਾਈ ਵੀ ਠੀਕ ਹੋਏ ਉੱਥੇ ਅੱਛਾ ਜੀ ਠੀਕ ਹੈ ਠੀਕ ਹੈ ਮੈਂ ਮਤਲਬ ਕਿ ਹੁਣ ਬੱਚੇ ਨੇ ਪੜ੍ਹਨਾ ਵਾ ਫਿਰ ਤਾਂ ਚਲੋ ਵਧੀਆ ਜਗ੍ਹਾ ਜਿੱਥੇ ਵਧੀਆ ਹੋਏ ਉੱਥੇ ਬੰਦਾ ਹਾਂਜੀ ਲਾਗੇ ਹੀ ਮਿਲੇ ਸੀ ਸਗੋਂ ਵਧੀਆ ਸਗੋਂ ਤੁਹਾਡੇ ਕੋਲ ਚਲੋ ਠੀਕ ਹੈ ਜੀ ਠੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ ਠੀਕ ਹੈ ਥੈਂਕ ਹਾਂਜੀ ਹਾਂਜੀ ਠੀਕ